ਟੀ ਵੀ ਪ੍ਰੋਗਰਾਮ ਦੇ ਵਿੱਚ ਮੈਨੂੰ ਤਾਂ ਕਪਲ ਸ਼ਰਮਾ ਸ਼ੋਅ ਪਸੰਦ ਹੈ ਜੋ ਕਿ ਬਹੁਤ ਹੀ ਵਧੀਆ ਇੰਟਰਟੇਨਮੈਂਟ ਸ਼ੋਅ ਆ ਇਹਦੇ ਵਿੱਚ ਬਹੁਤ ਹੀ ਵਧੀਆ ਮਤਲਬ ਹਾਸਾ ਮਖੌਲ ਕੀਤਾ ਜਾਂਦਾ ਕਪਲ ਸ਼ਰਮਾ ਦੇ ਦੁਆਰਾ ਲੋਕਾਂ ਦਾ ਵਧੀਆ ਮਨੋਰੰਜਨ ਕੀਤਾ ਜਾਂਦਾ ਅਤੇ ਇਹਦੇ ਵਿੱਚ ਕੋਈ ਖਾਸ ਐਕਟਰ ਜਾਂ ਕੋਈ ਖਾਸ ਸ਼ਖਸੀਅਤ ਨੂੰ ਸੱਦਾ ਦਿੱਤਾ ਜਾਂਦਾ ਅਤੇ ਉਸਦੀ ਉਸਦੀ ਕੋਈ ਵੀ ਫਿਲਮ ਦੀ ਪ੍ਰਮੋਸ਼ਨ ਕੀਤੀ ਜਾਂਦੀ ਆ ਜਾਂ ਉਹਦੀ ਜ਼ਿੰਦਗੀ ਬਾਰੇ ਚਾਨਣਾ ਪਾਇਆ ਜਾਂਦਾ ਹੈ ਅਤੇ ਉਹ ਵੀ ਜੋ ਵੀ ਕਿਸੇ ਖਾਸ ਗੈਸਟ ਨੂੰ ਸੱਦਿਆ ਜਾਂਦਾ ਉਹ ਆਪਣੀ ਆਪਣੀ ਵੀ ਪਰਫੋਰਮੈਂਸ ਕਰਕੇ ਜਾਂਦਾ ਜੋ ਕਿ ਲੋਕਾਂ ਨੂੰ ਬਹੁਤ ਵਧੀਆ ਲੱਗਦਾ ਅਤੇ ਹਾਸੇ ਦਾ ਜ਼ਿਆਦਾ ਇੰਟਰਟੇਨਮੈਂਟ ਕੀਤਾ ਜਾਂਦਾ ਇਸ ਸ਼ੋਅ ਦੇ ਵਿੱਚ ਕਪਲ ਸ਼ਰਮਾ ਦੀ ਜਿਹੜੀ ਕਮੇਡੀ ਆ ਉਹ ਬਹੁਤ ਵਧੀਆ ਅਤੇ ਬਹੁਤ ਹਾਸਾ ਪਾਉਂਦਾ ਕਪਲ ਸ਼ਰਮਾ ਸ਼ੋਅ ਦੇ ਵਿੱਚ ਇਸ ਲਈ ਇਹ ਬਹੁਤ ਵਧੀਆ ਸ਼ੋਅ ਆ ਸਾਰਿਆਂ ਨੂੰ ਬਹੁਤ ਪਸੰਦ ਹੈ